ਜੇ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੇ ਮਾਲੀਏ ਦੀ ਮਤਲਬ ਪੰਜਾਬ ਸਰਕਾਰ ਦੇ ਜੋ ਆਮਦਨ ਦੇ ਜਾਂ ਪੰਜਾਬ ਸਰਕਾਰ ਦੇ ਕਮਾਈ ਦੇ ਕੀ ਸਾਧਨ ਹਨ ਆਮਦਨ ਦੇ ਕੀ ਸਰੋਤ ਹਨ ਤਾਂ ਉਸ ਸਬੰਧੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਇਸ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਪੰਜਾਬ ਸਰਕਾਰ ਦੇ ਆਮਦਨ ਦੇ ਸਾਧਨ ਜਿਵੇਂ ਕਿ ਟੈਕਸ ਸਭ ਤੋਂ ਪਹਿਲਾਂ ਆਮ ਨਾਗਰਿਕ ਤੋਂ ਟੈਕਸ ਵਸੂਲਿਆ ਜਾਂਦਾ ਹੈ ਜੋ ਕਿ ਸਰਕਾਰ ਬਾਅਦ ਵਿੱਚ ਉਸ ਨਾਗਰਿਕ ਨੂੰ ਸੇਵਾਵਾਂ ਦੇ ਰੂਪ ਵਿੱਚ ਵਾਪਿਸ ਦਿੰਦੀ ਹੈ ਜਾਂ ਫਿਰ ਆਪਾਂ ਗੱਲ ਕਰੀਏ ਕਰਜ਼ੇ ਦੀ ਤਾਂ ਸਰਕਾਰ ਦੁਆਰਾ ਵੱਡੇ ਸੰਸਥਾਨਾਂ ਤੋਂ ਜਿਵੇਂ ਕਿ ਵਰਲਡ ਬੈਂਕ ਜਾਂ ਫਿਰ ਹੋਰ ਜੋ ਵੀ ਨਬਾਰਡ ਬੈਂਕ ਹੋ ਗਏ ਆਰ ਬੀ ਆਈ ਬੈਂਕ ਹੋ ਗਏ ਇਹਨਾਂ ਤੋਂ ਕਰਜ਼ਾ ਲਿਆ ਜਾਂਦਾ ਹੈ ਅਤੇ ਇੱਕ ਆਮ ਨਾਗਰਿਕ 'ਤੇ ਖਰਚਿਆ ਜਾਂਦਾ ਹੈ ਇਹ ਕੁਛ ਕੁ ਚੀਜ਼ਾਂ ਪੰਜਾਬ ਸਰਕਾਰ ਲਈ ਆਮਦਨ ਦੇ ਉਸਦੇ ਮਾਲੀਏ ਦੇ ਮੁੱਖ ਸਰੋਤ ਹਨ ਹੁਣ ਜੇ ਆਪਾਂ ਗੱਲ ਕਰੀਏ ਇਸ ਨੂੰ ਵੰਡਿਆ ਅਤੇ ਖਰਚਿਆ ਕਿਵੇਂ ਜਾਂਦਾ ਹੈ ਇਸ ਨੂੰ ਵੰਡਣ ਲਈ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਕਿ ਆਮ ਨਾਗਰਿਕ ਦੀਆਂ ਜਰੂਰਤਾਂ ਕੀ ਕੀ ਹਨ ਸਭ ਤੋਂ ਪਹਿਲਾਂ ਇਹ ਧਿਆਨ 'ਚ ਲਿਆਂਦਾ ਜਾਂਦਾ ਹੈ ਕਿ ਇਸ ਵਾਰ ਜੋ ਆਮਦਨ ਹੋਈ ਹੈ ਪੂਰੇ ਸਾਲ ਦੀ ਆਮਦਨ ਨੂੰ ਕਿਸ ਤਰ੍ਹਾਂ ਵੰਡਿਆ ਜਾਵੇ ਕਿ ਉਸ ਨੂੰ ਵੱਧ ਤੋਂ ਵੱਧ ਯੂਟੀਲਾਈਜ ਕਰਕੇ ਇੱਕ ਆਮ ਨਾਗਰਿਕ ਨੂੰ ਉਸ ਦਾ ਸਭ ਤੋਂ ਵੱਧ ਲਾਭ ਮਿਲ ਸਕੇ ਅਤੇ ਉਹ ਕਿਸ ਤਰ੍ਹਾਂ ਖਰਚਿਆ ਜਾਵੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਯੂਟੀਲਾਈਜ ਹੋ ਸਕੇ ਉਸਦੇ ਵਿੱਚ ਵੇਸਟਜ ਘੱਟ ਹੋ ਸਕੇ ਅਤੇ ਉਸਦਾ ਵੱਧ ਤੋਂ ਵੱਧ ਫ਼ਾਇਦਾ ਇੱਕ ਆਮ ਨਾਗਰਿਕ ਨੂੰ ਮਿਲ ਸਕੇ ਪੰਜਾਬ ਸਰਕਾਰ ਲਈ ਮਾਲੀਏ ਦੇ ਮੁੱਖ ਸਰੋਤ ਟੈਕਸ ਗ੍ਰਾਂਟਾਂ ਕਰਜ਼ੇ ਆਦਿ ਹਨ ਧੰਨਵਾਦ